ਪੰਜ ਅਕਤੂਬਰ ਦੋ ਹਜ਼ਾਰ ਪੰਜ ਉਨੱਤੀ ਜਨਵਰੀ ਉੱਨੀ ਸੌ ਸਤਾਨਵੇਂ ਛੱਬੀ ਸਤੰਬਰ ਉੱਨੀ ਸੌ ਛਿਆਨਵੇਂ ਚਾਰ ਜੁਲਾਈ ਉੱਨੀ ਸੌ ਚੌਹਠ ਇਕ ਜੁਲਾਈ ਉੱਨੀ ਸੌ ਪਚਵੰਜਾ ਦੋ ਅਕਤੂਬਰ ਉੱਨੀ ਸੌ ਅਠਤਾਲੀ